ਮੇਰਾ ਨਾਮ ਨੈਨਸੀ ਹੈ ਸਾਨੂੰ ਆਪਣੇ ਰਾਜ ਸਮਾਜ ਦੇ ਸੱਭਿਆਚਾਰਕ ਪਰੰਪਰਾਗਤ ਪਹਿਰਾਵੇ ਕੱਪੜੇ ਗਹਿਣੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਰਾਜ ਵਿੱਚ ਬਹੁਤ ਸਾਰੇ ਪਰੰਪਰਾਗਤ ਜਿਵੇਂ ਕਿ ਭੰਗੜਾ ਗਿੱਧਾ ਆਦਿ ਪਹਿਰਾਵੇ ਪਾਉਂਦੇ ਹਨ ਸਾਡੇ ਰਾਜ ਦੇ ਪਹਿਰਾਵੇ ਬਹੁਤ ਹੀ ਵਧੀਆ ਹੁੰਦੇ ਹਨ ਜੇਕਰ ਕਿਤੇ ਮੇਲਾ ਲੱਗਦਾ ਹੈ ਤਾਂ ਉਹ ਪਹਿਰਾਵੇ ਦੇ ਨਾਲ ਆਉਂਦੇ ਹਨ ਜਦੋਂ ਕੁੜੀਆਂ ਗਿੱਧਾ ਪਾਉਂਦੀਆਂ ਹਨ ਉਹ ਵੀ ਪੂਰੇ ਪਹਿਰਾਵੇ ਦਿੱਤੇ ਗਹਿਣੇ ਪਾ ਕੇ ਆਉਂਦੀਆਂ ਹਨ ਅਤੇ ਇੱਕ ਪੰਜਾਬ ਦਾ ਪਹਿਰਾਵਾ ਦੱਸਦੇ ਹਨ ਕਿ ਕਿਵੇਂ ਦਾ ਹੁੰਦਾ ਹੈ ਸਾਡੇ ਪੰਜਾਬ ਦਾ ਪਹਿਰਾਵਾ ਅਤੇ ਮੁੰਡੇ ਜਦੋਂ ਭੰਗੜਾ ਪਾਉਂਦੇ ਹਨ ਤਾਂ ਉਹ ਵੀ ਆਪਣਾ ਪੂਰਾ ਪਹਿਰਾਵਾ ਪਾ ਕੇ ਆਉਂਦੇ ਹਨ ਅਤੇ ਦੱਸਦੇ ਹਨ ਕਿ ਕਿਵੇਂ ਹੁੰਦਾ ਹੈ ਪੰਜਾਬ ਦਾ ਪਹਿਰਾਵਾ